ਹਾਂਜੀ ਮੈਂ ਹੱਥ ਨਾਲ ਬਣੇ ਕਾਰਡ ਆਪਣੀ ਫਰੈਂਡ ਨੂੰ ਬਰਡੇ ਗਿਫਟ 'ਤੇ ਦਿੰਦੀ ਹੁੰਦੀ ਹਾਂ ਹੱਥ ਨਾਲ ਬਣਾ ਕੇ ਕਾਰਡ ਦਿੰਦੀ ਹੁੰਦੀ ਹਾਂ ਨਿਊ ਈਅਰ 'ਤੇ ਕਾਰਡ ਦਿੱਤੇ ਨੇਗੇ ਬਹੁਤ ਜ਼ਿਆਦਾ ਬਣਾ ਬਣਾ ਕੇ ਮੈਨੂੰ ਇੰਝ ਲੱਗਦਾ ਵੀ ਜਿਹੜੀ ਮੈਂ ਚੀਜ਼ ਹੱਥ ਨਾਲ ਬਣਾਈ ਆ ਉਹ ਮੇਰੇ ਦੋਸਤਾਂ ਨੂੰ ਬਹੁਤ ਪਸੰ ਮੇਰੇ ਦੋਸਤਾਂ ਨੂੰ ਬਹੁਤ ਪਸੰਦ ਹੋਊਗੀ ਅਤੇ ਉਹ ਸਭ ਤੋਂ ਅਲੱਗ ਡਿਫਰੈਂਟ ਜਿਹੀ ਚੀਜ਼ ਹੁੰਦੀ ਹੈ ਅਤੇ ਮੈਂ ਕ ਬਹੁਤ ਜ਼ਿਆਦਾ ਆਈਡੀਆ ਲੈ ਲੈ ਕੇ ਯੂਟਿਊਬ ਤੋਂ ਗੂਗਲ ਤੋਂ ਕਿਸੇ ਤੋਂ ਪੁੱਛ ਕੇ ਜਾਂ ਕੋਈ ਚੀਜ਼ ਦੇਖੀ ਹੁੰਦੀ ਹੈ ਉਹਨਾਂ ਤੋਂ ਆਈਡੀਆਜ਼ ਲੈ ਲੈ ਕੇ ਆਪਣੇ ਫਰੈਂਡਸ ਲਈ ਕਾਰਡ ਬਣਾਏ ਨੇਗੇ ਈਵਨ ਕਿ ਮੈਂ ਆਪਣੀ ਫਰੈਂਡ ਨੂੰ ਉਹਦੇ ਬਰਡੇ 'ਤੇ ਇੱਕ ਜੈਕਟ ਵੀ ਬੁਣ ਕੇ ਦਿੱਤੀ ਸੀਗੀ ਅਤੇ ਮੈਂ ਬੁਣਨਾ ਆਪਣੀ ਮੰਮ ਮੰਮਾ ਤੋਂ ਸਿੱਖਿਆ ਆ ਉਹਨਾਂ ਨੂੰ ਦੇਖ ਦੇਖ ਕੇ ਹੀ ਮੈਂ ਸਿੱਖੀ ਗਈ ਸੀ ਇਸ ਲਈ ਅਤੇ ਬਾਅਦ ਵਿੱਚ ਮੈਂ ਆਪਣੀ ਫਰੈਂਡ ਨੂੰ ਇੱਕ ਵਧੀਆ ਜਿਹੀ ਜੈਕਟ ਬੁਣ ਕੇ ਦਿੱਤੀ ਸੀਗੀ ਮੈਨੂੰ ਇੰਝ ਲੱਗਦਾ ਹੈਗਾ ਵੀ ਜਿਹੜੀ ਆਪਾਂ ਨੇ ਹੱਥ ਨਾਲ ਬਣਾਈਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਆਪਾਂ ਬਹੁਤ ਹੀ ਪਿਆਰ ਨਾਲ ਬਹੁਤ ਹੀ ਜਿਨ੍ਹਾਂ ਦਾ ਆਪਾਂ ਦਿਲ ਤੋਂ ਕਰਦੇ ਹਾਂ ਉਹਨਾਂ ਨੂੰ ਹੀ ਗਿਫਟ ਦਿੰਦੇ ਹਾਂ ਵੀ ਤਾਂ ਜੋ ਸੰਭਾਲ ਕੇ ਸ ਰੱਖ ਸਕਣ ਅਤੇ ਹਮੇਸ਼ਾ ਲਈ ਉਹਨਾਂ ਨੂੰ ਆਪਣੇ ਕੋਲ ਸਾਂਭੀਆਂ ਰੱਖਣ ਅਤੇ ਉਹਨਾਂ ਲਈ ਇੱਕ ਯਾਦ ਬਣ ਜਾਵੇ